ਹਾਂ ਖਿੱਚਣ ਵੇਲੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਜਾਂ ਦਿੱਕਤਾਂ ਖੜੀਆਂ ਹੋ ਜਾਂਦੀਆਂ ਨੇ ਜਿਵੇਂ ਕਈ ਵਾਰ ਕੁਦਰਤੀ ਖੋਜ ਕੁਦਰਤ ਦੇ ਲੈਣੇ ਹੋਣ ਪਰ ਉਹ ਕਈ ਵਾਰੀ ਕੈਮਰੇ ਦੇ ਵਿੱਚ ਵੀ ਨਹੀਂ ਆਉਂਦੇ ਤੇ ਉਹਨਾਂ ਤੱਕ ਪਹੁੰਚ ਵੀ ਨਹੀਂ ਹੋ ਸਕਦੀ ਤੇ ਕਈ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਜਿਵੇਂ ਕਿਸੇ ਕਪਲ ਦੀਆਂ ਹੋਣ ਤਾਂ ਮਤਲਬ ਉਹ ਤਸਵੀਰ ਲੈਣੀ ਵੀ ਬਹੁਤ ਔਖੀ ਹੋ ਜਾਂਦੀ ਹੈ ਤੇ ਕਈ ਹੋਰ ਜਿਵੇਂ ਆਪਾਂ ਕਿਸੇ ਜਗ੍ਹਾ ਤੇ ਜਾਦੇ ਆ ਉਥੇ ਤਸਵੀਰ ਲੈਣ ਦੇ ਵਿੱਚ ਇਹ ਵੀ ਪਰੇਸ਼ਾਨੀ ਆ ਜਾਂਦੀ ਹੈ ਕਿ ਉੱਥੇ ਉਹ ਤਸਵੀਰਕਾਰੀ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੁੰਦੀ ਹੈ ਜੋ ਕੈਮਰੇ ਦੇ ਵਿੱਚ ਚੀਜ਼ਾਂ ਕੈਦ ਨਹੀਂ ਹੋ ਸਕਦੀਆਂ ਤਸਵੀਰਾਂ ਲੈਣ ਦਾ ਮਕਸਦ ਹੁੰਦਾ ਗਾ ਕਿ ਇੱਕ ਸਾ ਆਪਣੀ ਯਾਦ ਰਹਿ ਜਾਂਦੀ ਹੈ ਜੋ ਕਿ ਕਿਸੇ ਵੀ ਵੇਲੇ ਤੁਸੀਂ ਉਸਨੂੰ ਦੇਖ ਕੇ ਆਪਣਾ ਬੀਤਿਆ ਆਪਣਾ ਭੂਤ ਕਾਲ ਆਪਣੀ ਕੋਈ ਯਾਦ ਤਾਜ਼ੀ ਕਰ ਸਕਦੇ ਹੋ ਤਸਵੀਰਾਂ ਲੈਣੀਆਂ ਬਹੁਤ ਵਧੀਆ ਕਾਰਜ ਹੈ ਜੋ ਕਿ ਸਾਰੇ ਹੀ ਖੇਤਰਾਂ ਦੇ ਵਿੱਚ ਵਿਦਿਅਕ ਖੇਤਰ ਖੇਡ ਖੇਤਰ ਜਾ ਮਨੋਰੰਜਨ ਦੇ ਹੋਰ ਕਈ ਖੇਤਰ ਨੇ ਉੱਥੇ ਲਈਆਂ ਜਾਂਦੀਆਂ ਹਨ ਇਸ ਲਈ ਉਹਨਾਂ ਨੂੰ ਜੋ ਤਸਵੀਰਕਾਰੀ ਦੀਆਂ ਦਿੱਕਤਾਂ ਹੁੰਦੀਆਂ ਨੇ ਇਹਨਾਂ ਨੂੰ ਸਾਹਮਣਾ ਦੂਰ ਕਰਨ ਦਾ ਤਾਂ ਦੇਖੋ ਮੌਕਾ ਹੀ ਦੱਸ ਸਕਦਾ ਕਿਵੇਂ ਦੂਰ ਕੀਤਾ ਜਾ ਸਕਦਾ